ਮੇਰਾ ਪਹਿਲਾ ਕੰਮ ਇੱਧਰੋਂ ਜਦੋਂ ਕੰਮ ਤੋਂ ਜਾਂਦਾ ਜੀ ਉਹਨਾਂ ਖਾਤਰ ਜਾਣੀ ਕਿ ਚੀਜ਼ ਵਗੈਰਾ ਲੈ ਕੇ ਜਾਂਦਾ ਖਾਣ ਚੀਜ਼ ਟੋਫੀਆਂ ਵਗੈਰਾ ਜਾਂ ਚਿਪਸ ਵਗੈਰਾ ਇੱਦਾਂ ਇੱਦਾਂ ਦਾ ਕੁਝ ਲੈ ਜਾਂਦਾ ਉਹਨਾਂ ਨੂੰ ਚੀਜ਼ ਦੇ ਦਈਦੀ ਆ ਮੁੜਕੇ ਕੀ ਕਰਦਾ ਦੁਬਾਰਾ ਫੇਰ ਉਹ ਥੋੜ੍ਹੀ ਦੇਰ ਬਾਅਦ ਆਖਣਗੇ ਜਾਂ ਮਤਲਬ ਵੀ ਸ਼ਾਮ ਤੀਕਰ ਫਿਰ ਆਖਣਗੇ ਵੀ ਕੋਈ ਚੀਜ਼ ਚਾਹੀਦੀ ਸਾਨੂੰ ਖਾਣ ਨੂੰ ਫਿਰ ਦੁਕਾਨ 'ਤੇ ਮੋਟਰਸਾਈਕਲ 'ਤੇ ਉਹਨਾਂ ਨੂੰ ਲੈ ਜਾਈਦਾ ਨਾਲ ਲੈ ਕੇ ਚੀਜ਼ਾਂ ਵਗੈਰਾ ਮੰਗਦੇ ਉਹਨਾਂ ਨੂੰ ਦਿਵਾ ਦਈ ਦੀਆਂ ਠੀਕ ਆ ਜੀ ਫਿਰ ਬਹੁਤ ਸ਼ਰਾਰਤੀ ਮੇਰੇ ਨਾਲ ਬਹੁਤ ਚੌੜ ਕਰਦੇ ਉਹਨਾਂ ਨੂੰ ਮਤਲਬ ਕਿ ਜਿਵੇਂ ਪੁਰਾਣੇ ਸਮੇਂ 'ਚ ਜਿਵੇਂ ਸਾਡੇ ਮੇਰੇ ਫਾਦਰ ਸਾਹਿਬ ਸਾਨੂੰ ਮੋਢਿਆਂ 'ਤੇ ਚੁੱਕ ਕੇ ਜਾਣੀ ਕਿ ਖਿਡਾਉਂਦੇ ਹੁੰਦੇ ਸੀ ਝੂਟੇ ਵਗੈਰਾ ਦਿੰਦੇ ਹੁੰਦੇ ਸੀ ਇੱਦਾਂ ਇੱਦਾਂ ਉਹਨਾਂ ਨੂੰ ਐਂ ਬਾਹਰ ਲੈ ਜਾਈਦਾ ਜਾਂ ਖੇਤ ਬੰਨੇ ਲੈ ਜਾਈਦਾ ਉਹਨਾਂ ਨੂੰ ਇੱਦਾਂ ਵਗੈਰਾ ਉਹਨਾਂ ਨੂੰ ਝੂਟੇ ਦਈਦੇ ਆ ਉਹਨੂੰ ਮਤਲਬ ਕੇ ਖੁਸ਼ ਰੱਖੀਦਾ ਇੱਦਾਂ ਅਤੇ ਜਾਂ ਹੋਰ ਵੀ ਜੋ ਵੀ ਬੱਚੇ ਮਤਲਬ ਵੀ ਚੀਜ਼ ਮੰਗਦੇ ਉਹਨਾਂ ਨੂੰ ਬਾਹਰੋਂ ਕੋਈ ਚੀਜ਼ ਉਹ ਜਿਹੀ ਲਿਆ ਕੇ ਦਈ ਦੀ ਦੁਕਾਨ ਤੋਂ ਅਤੇ ਬਹੁਤ ਜ਼ਿਆਦਾ ਸ਼ਰਾਰਤੀ ਬਹੁਤ ਆ ਜੀ ਕਦੇ ਬੈੱਡਾਂ ਦੇ ਉੱਪਰ ਚੜ੍ਹ ਜਾਣ ਕਦੇ ਨੀਚੇ ਮੇਰੇ ਉੱਪਰ ਛਾਲਾਂ ਮਾਰਦੇ ਜਦੋਂ ਵੀ ਜਾਂਦੇ ਹਾਂ ਇੱਦਾਂ ਦਾ ਕਰਦੇ ਆ ਜਾਣੀ ਕਿ ਬੱਚਿਆਂ ਨੂੰ ਖੁਸ਼ ਹੀ ਰੱਖੀਦਾ ਜੀ ਅਤੇ ਇੱਦਾਂ ਦਾ ਇੱਕ ਬਹੁਤ ਜ਼ਿਆਦਾ ਪਿਆਰ ਕਰਦੇ ਆ ਬੱਚੇ ਨੂੰ ਅਤੇ ਖਾਣਾ ਵੀ ਮੇਰੇ ਨਾਲ ਹੀ ਖਾਂਦੇ ਹੈ ਜੀ ਬੱਚੇ ਇੱਦਾਂ ਦੀ ਕੋਈ ਗੱਲ ਨਹੀਂ ਜਦੋਂ ਜਾਂਦਾ ਮੈਂ ਉਹਦੇ ਨਾਲ ਹੀ ਖਾਣਾ ਬਸ ਛੋਟੇ ਬੱਚਿਆਂ ਦਾ ਕੀ ਕੰਮ ਹੁੰਦਾ ਗਾ ਅਤੇ ਉਹਨਾਂ ਨੂੰ ਮਤਲਬ ਕਿ ਫਿਰ ਸੁਬਾਹ ਮਤਲਬ ਕਿ ਉਹਨੂੰ ਤਿਆਰ ਕਰਕੇ ਸਕੂਲ ਵੀ ਛੱਡ ਕੇ ਆਉਣਾ ਪੈਂਦਾ ਸਕੂਲ ਵੀ ਛੱਡ ਕੇ ਆਈਦਾ ਸਕੂਲ ਛੱਡ ਕੇ ਆਉਂਦੇ ਫੇਰ ਵੀ ਬੱਚੇ ਚੀਜ਼ੀ ਮੰਗਦੇ ਉਹਨੂੰ ਚੀਜ਼ੀ ਦਿਵਾ ਕੇ ਉਹਨੂੰ ਛੱਡਿਆ ਜਾਂਦਾ ਸਕੂਲ ਅਤੇ ਦੁਬਾਰਾ ਫਿਰ ਜਦੋਂ ਉਹਨਾਂ ਦਾ ਮਤਲਬ ਦੋ ਵਜੇ ਦਾ ਟਾਈਮ ਹੋਏਗਾ ਅਤੇ ਉਦੋਂ ਫਿਰ ਉਹਨਾਂ ਨੂੰ ਮੋਟਰਸਾਈਕਲ 'ਤੇ ਜਾ ਕੇ ਸਕੂਲੋਂ ਲਿਆਈਦਾ ਜੀ ਅਤੇ ਫਿਰ ਫਿਰ ਚੀਜ਼ੀ ਮੰਗਦੇ ਆ ਉਹਨੂੰ ਵਗੈਰਾ ਜਾਂ ਕੁਛ ਚੀਜ਼ ਦਵਾ ਦਈਦੀ ਹੈ ਠੀਕ ਹੈ ਫਿਰ ਘਰ ਆ ਜਾਂਦੇ ਜੀ ਘਰ ਆ ਕੇ ਫਿਰ ਕੁਛ ਟਾਈਮ ਰੈਸਟ ਕਰਦੇ ਆ ਬੱਚੇ ਫਿਰ ਮਤਲਬ ਕਿ ਫੇਰ ਖਾਣਾ ਖਾਂਦੇ ਆ ਫਿਰ ਉਹਨਾਂ ਨੇ ਮੇਰੇ ਨਾਲ ਹੀ ਖਾਣਾ ਖਾਣਾ ਇੱਦਾਂ ਕਰਦੇ ਆ ਬੱਚੇ ਅਤੇ ਬਾਕੀ ਬੱਚੇ ਇੱਦਾਂ ਹੀ ਕਰਦੇ ਆ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਬੱਚਿਆਂ ਨੂੰ ਥੈਂਕ ਯੂ